ਭੰਗੜਾ ਭੰਗੜੇ ਦੇ ਮਨੇ ਜਿਵੇਂ ਕਿ ਆਪਣੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਭੰਗੜੇ ਪਾਏ ਜਾਂਦੇ ਹਨ ਉੱਥੇ ਆਪਾਂ ਨੂੰ ਜੋ ਵੀ ਭੰਗੜਾ ਸਿਖਾਉਣ ਵਾਲੇ ਟੀਚਰ ਦੱਸਦੇ ਹਨ ਭੰਗੜਾ ਸਿਖਾਉਣ ਵਾਲੇ ਟੀਚਰ ਦੱਸਦੇ ਹਨ ਵੀ ਭੰਗੜਾ ਕਿਸ ਤਰ੍ਹਾਂ ਪਾਇਆ ਜਾਂਦਾ ਹੈਗਾ ਭੰਗੜੇ ਨੂੰ ਸਿੱਖਣ ਲਈ ਕੀ ਕੀ ਚੀਜ਼ ਦੀ ਜ਼ਰੂਰਤ ਪੈਂਦੀ ਆ ਭੰਗੜੇ ਨੂੰ ਪਾਉਣ ਲਈ ਕਿਹੜੇ ਕਿਹੜੇ ਸਟੈਪ ਦੀ ਲੋੜ ਪੈਂਦੀ ਹੈ ਜਾਂ ਭੰਗੜਾ ਕਿਸ ਤਰ੍ਹਾਂ ਪਾਇਆ ਜਾਂਦਾ ਹੈਗਾ ਪਹਿਲਾਂ ਤਾਂ ਆਪਾਂ ਭੰਗੜਾ ਪਾਉਣ ਲਈ ਜੋ ਕਿ ਆਪਣਾ ਭੰਗੜੇ ਵਾਲਾ ਪਹਿਰਾਵਾ ਹੁੰਦਾ ਉਹਦੇ ਵਿੱਚ ਆਉਣਾ ਪੈਂਦਾ ਉੱਪਰ ਕਿਉਂਕਿ ਆਪਾਂ ਨੂੰ ਸਿਰ ਉੱਪਰ ਇੱਕ ਪੱਗ ਵੀ ਸਜਾਉਣੀ ਪੈਂਦੀ ਹੈਗੀ ਫਿਰ ਆਪਾਂ ਨੂੰ ਭੰਗੜੇ ਦੀ ਤਿਆਰੀ ਕਰਨ ਨਾਲ ਜੋ ਕਿ ਭੰਗੜੇ ਦੇ ਵਿੱਚ ਆਪਾਂ ਨੂੰ ਕੁਛ ਕ ਇਹ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਵੀ ਜਿਸ ਦੇ ਨਾਲ ਆਪਣਾ ਭੰਗੜਾ ਜ਼ਿਆਦਾ ਵਧੀਆ ਅਤੇ ਜ਼ਿਆਦਾ ਸੋਹਣਾ ਲੱਗੇ ਭੰਗੜੇ ਦੇ ਕੁਛ ਪਹਿਲਾਂ ਸਟੈਪ ਪੰਜਾਬ ਸਟੈਪ ਮਾਨੇ ਵੀ ਇੱਕ ਲੈਗ ਨੂੰ ਦੂਜੀ ਲੈਗ ਥਾਂ 'ਤੇ ਚੱਕਣਾ ਅਤੇ ਦੂਜੀ ਥਾਂ ਤੋਂ ਫਿਰ ਦੂਜੀ ਥਾਂ 'ਤੇ ਲੈਗ ਨੂੰ ਚੱਕਣਾ ਇਹਨੂੰ ਆਪਾਂ ਪਹਿਲਾ ਸਟੈਪ ਕਹਿੰਦੇ ਆ ਦੂਜੇ ਸਟੈਪ ਨੂੰ ਕਹਿੰਦੇ ਹਾਂ ਆਪਾਂ ਫੁਲਕਾ ਫੁਲਕਾ ਹੱਥ ਹੱਥ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਤਾੜੀ ਵਜਾਉਣਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਦੂਜੇ ਹੱਥ ਨੂੰ ਇੱਧਰੋਂ ਚੱਕ ਕੇ ਦੂਜੀ ਹੱਥ 'ਤੇ ਤਾੜੀ ਵਜਾਉਣਾ ਤੀਜਾ ਸਟੈਪ ਹੈਗਾ ਆਪਣਾ ਜੰਡੂ ਸਿੰਘਾ ਜਿਹਨੂੰ ਆਪਾਂ ਮੋਰਚਾਲ ਵੀ ਕਹਿ ਦਿੰਦੇ ਹੈਗੇ ਉਹ ਆਪਾਂ ਪੈਰਾਂ ਦੇ ਨਾਲ ਕਰਨਾ ਵੀ ਅਤੇ ਚੌਥਾ ਸਟੈਪ ਆ ਪ ਆਪਣਾ ਘੋੜਾ ਘੋੜਾ ਚਾਲ ਅਤੇ ਪੰਜਵਾਂ ਸਟੈਪ ਆ ਗਿਆ ਆਪਣਾ ਝੂੰਮਰ ਛੇਵਾਂ ਸਟੈਪ ਆ ਗਿਆ ਆਪਣਾ ਤੇਜ਼ ਤਾੜੀ ਝੂੰਮਰ ਜੇ ਚੌਥਾ ਸੱਤਵਾਂ ਸਟੈਪ ਆ ਗਿਆ ਆਪਣਾ ਲੁੱਡੀ ਪੰਜਵਾਂ ਨੌਵਾਂ ਸਟੈਪ ਆ ਗਿਆ ਨਾ ਭੰਗੜਾ ਚਾਲ ਇਹਦੇ ਨਾਲ ਤੇਜ਼ ਚਾਲ ਹੋ ਜਾਂਦੀ ਆਪਣੀ ਕਿਉਂਕਿ ਆਪਣਾ ਭੰਗੜਾ ਹੋਰ ਵੀ ਸੋਹਣਾ ਲੱਗਣ ਲੱਗ ਜਾਂਦਾ ਹੈਗਾ ਔਰ ਦਸਵਾਂ ਸਟੈਪ ਹੈਗਾ ਆਪਣਾ ਜਾਫਾ ਇਹ ਆਪਣੇ ਕੁਛ ਭੰਗੜੇ ਦੇ ਸਟੈਪ ਹਨ ਜੋ ਕਿ ਆਪਾਂ ਭੰਗੜੇ ਵਿੱਚ ਯੂਜ ਕਰਦੇ ਹਾਂ ਜੋ ਕਿ ਆਪਣਾ ਭੰਗੜਾ ਸੋਹਣਾ ਲੱਗੇ